ਪੰਜਾਬ ਵਿੱਚ ਆਵਾਜਾਈ ਦੇ ਅਤੇ ਰਵਾਇਤੀ ਢੰਗ ਵਿੱਚ ਅੱਜ ਦੇ ਸਮੇਂ ਵਿੱਚ ਬਹੁਤ ਵਿਕਾਸ ਹੋਇਆ ਹੈ ਜਿਵੇਂ ਪੁਰਾਣੇ ਲੋਕ ਬੈਲ ਗੱਡੀਆਂ 'ਤੇ ਬੈਲ ਗੱਡੀਆਂ 'ਤੇ ਸਫਰ ਕਰਦੇ ਸੀ ਘੋੜਿਆਂ 'ਤੇ ਸਵਾਰੀ ਕਰਦੇ ਸੀ ਘੋੜਿਆਂ 'ਤੇ ਆਉਣ ਜਾਣ ਦਾ ਉਹਨਾਂ ਦਾ ਆਉਣ ਜਾਣ ਦਾ ਸਾਧਨ ਘੋੜਿਆਂ ਦਾ ਹੁੰਦਾ ਸੀ ਅੱਜ ਦੇ ਸਮੇਂ ਵਿੱਚ ਹਰ ਬ ਹਰ ਇੱਕ ਬੰਦੇ ਕੋਲ ਆਪਣੇ ਆਵਾਜਾਈ ਦੇ ਸਾਧਨ ਹੁੰਦੇ ਹਨ ਮੋਟਰਸਈਕਲਾਂ ਸਕੂਟੀਆਂ ਰੇਲ ਗੱਡੀਆਂ ਸਭ ਕੁਛ ਹੋ ਗਿਆ ਹੈ ਅਤੇ ਲੋਕਾਂ ਨੇ ਆਉਣ ਜਾਣ ਵਿੱਚ ਰੇਲ ਗੱਡੀਆਂ ਨੇ ਬੱਸਾਂ ਨੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਹੈ ਇਹਨਾਂ ਰਾਹੀਂ ਲੋਕ ਆਪਣੇ ਸਫਰ ਜਲਦੀ ਅਤੇ ਚੰਗੀ ਤਰ੍ਹਾਂ ਤੈਅ ਕਰ ਲੈਂਦੇ ਹਨ